ਪੰਜਾਬ ਦੇ ਕੁਦਰਤੀ ਸਰੋਤ ਅਤੇ ਉਹਨਾਂ ਦੇ ਵਪਾਰਿਕ ਉਪਯੋਗ ਪੰਜਾਬ ਭਾਰਤ ਦਾ ਇੱਕ ਅਮੀਰ ਖੇਤੀਬਾੜੀ ਅਤੇ ਉਦਯੋਗਿਕ ਰਾਜ ਹੈ ਇੱਥੇ ਕਈ ਤਰ੍ਹਾਂ ਦੇ ਕੁਦਰਤੀ ਸਰੋਤ ਪਾਏ ਜਾਂਦੇ ਹਨ ਜੋ ਵਪਾਰਿਕ ਗਤੀਵਿਧੀਆਂ ਲਈ ਵਰਤੇ ਜਾਂਦੇ ਹਨ ਆਓ ਇਹਨਾਂ ਬਾਰੇ ਵਿਸਮਰਤ ਨਾਲ ਜਾਣੀਏ ਜਲ ਸਰੋਤ ਨਦੀਆਂ ਸਤਲੁਜ ਬਿਆਸ ਅਤੇ ਰਾਵੀ ਨਦੀਆਂ ਪੰਜਾਬ ਦੀ ਜੀਵਨ ਰੇਖਾ ਹਨ ਇਹਨਾਂ ਨਦੀਆਂ ਦਾ ਪਾਣੀ ਸਿੰਚਾਈ ਪੀਣ ਲਈ ਅਤੇ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ

ਉਦਯੋਗਾਂ ਲਈ ਵਰਤਿਆ ਜਾਂਦਾ ਹੈ ਖੇਤੀਬਾੜੀ ਉਤਪਾਦ ਅਨਾਜ ਪੰਜਾਬ ਨੂੰ ਭਾਰਤ ਆਧਾਰ ਅਨਾਜ ਦਾ ਟੋਕਰਾ ਕਿਹਾ ਜਾਂਦਾ ਹੈ ਇੱਥੇ ਗੇਹੂੰ ਚਾਵਲ ਮੱਕੀ ਅਤੇ ਬਾਜਰਾ ਵਰਗੇ ਅਨਾਜ ਦੀ ਵੱਡੀ ਮਾਤਰਾ ਵਿੱਚ ਕਾਸ਼ਤ ਕੀਤੀ ਜਾਂਦੀ ਹੈ ਦਾਲਾਂ ਮਸੂਰ ਚਣਾ ਮੂੰਗੀ ਅਤੇ ਉੜਦ ਵਰਗੀਆਂ ਦਾਲਾਂ ਪੰਜਾਬ ਵਿੱਚ ਪੈਦਾ ਕੀਤੀਆਂ ਜਾਂਦੀਆਂ ਹਨ ਕਪਾਹ ਪੰਜਾਬ ਕਪਾਹ ਉਤਪਾਦਨ ਲਈ ਮਸ਼ਹੂਰ ਹੈ ਐਸੋ ਪੈਦਾ ਹੋਈ ਕਪਾਹ ਤੋ ਕੱਪੜਾ ਬਣਾਇਆ ਜਾਂਦਾ ਹੈ ਫਲ ਅਤੇ ਸਬਜ਼ੀਆਂ ਆਮ ਅੰਗੂਰ ਸੰਤਰਾ ਅਤੇ ਹੋਰ ਫਲਾਂ ਦੇ ਨਾਲ ਗੋਭੀ ਗਾਜਰ ਅਤੇ ਹੋਰ ਸਬਜ਼ੀਆਂ ਵੀ ਪੰਜਾਬ ਵਿੱਚ ਉਗਾਈਆਂ ਜਾਂਦੀਆਂ ਹਨ ਖਣਿਜ ਕੋਲਾ ਪੰਜਾਬ ਵਿੱਚ ਕੋਲਾ ਵੀ ਵ ਪਾਇਆ ਜਾਂਦਾ ਹੈ ਜਿਸ ਨੂੰ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ ਜੀਵ ਜੰਤੂ ਮੱਛੀਆਂ ਪੰਜਾਬ ਦੀਆਂ ਨਦੀਆਂ ਵਿੱਚ ਕਈ ਤਰ੍ਹਾਂ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ ਮੱਛੀ ਪਾਲਣ ਇੱਥੇ ਇੱਕ ਮਹੱਤਵਪੂਰਨ ਵਪਾਰਕ ਗਤੀਵਿਧੀ ਹੈ